ਹੈਲੋ ਮੀਸ਼ੋ ਤੋਂ ਗੱਲ ਕਰ ਰਹੇ ਆ ਜੀ ਜੀ ਮੈਂ ਤੁਹਾਡਾ ਕਸਟਮਰ ਗੁਰਜੰਟ ਸਿੰਘ ਗੱਲ ਕਰ ਰਿਹਾ ਜੀ ਜੀ ਹਾਂਜੀ ਮੈਂ ਤੁਹਾਡੇ ਕੋਲ ਨਾ ਦੋ ਆਡਰ ਕੀਤੇ ਸੀਗੇ ਇੱਕ ਵਿ ਜਿਸ ਵਿੱਚ ਇੱਕ ਕੁੜਤਾ ਸੀਗਾ ਇੱਕ ਮੇਰਾ ਲੋਅਰ ਸੀਗਾ ਹਾਂਜੀ ਜਿਹੜਾ ਤੁਸੀਂ ਕੁੜਤਾ ਭੇਜਿਆ ਹੋਇਆ ਨਾ ਉਹ ਸਾਨੂੰ ਤੁਸੀਂ ਛੋਟਾ ਭੇਜ ਦਿੱਤਾ ਇੱਕ ਉਹਦੀ ਕੁਆਲਿਟੀ ਨਹੀਂ ਏਡੀ ਵਧੀਆ ਉਹਦੇ ਇੱਕ ਤਾਂ ਬਟਨ ਕੰਪਲੀਟ ਨਹੀਂ ਲੱਗੇ ਹੋਏ ਅਤੇ ਇੱਕ ਉਹ ਸਾਈਜ਼ ਤੁਸੀਂ ਬਹੁਤ ਹੀ ਛੋਟਾ ਘੱਲ ਤਾ ਤੀਜਾ ਉਹਦੇ 'ਚ ਜਿਹੜਾ ਉਹਦਾ ਕਲਰ ਸੀਗਾ ਉਹ ਮੈਨੂੰ ਕਲਰ ਕਲਰ ਵੀ ਉਹ ਚੀਜ਼ ਨਹੀਂ ਭੇਜਿਆ ਮੈਂ ਮਾਰਕੀਟ 'ਚੋਂ ਲੱਭਦਾ ਰਿਹਾ ਸੀ ਉਹ ਚੀਜ਼ ਨਹੀਂ ਮਿਲੀ ਮੈਨੂੰ ਤੁਹਾਡੀ ਸਾਈਡ 'ਤੇ ਮਿਲੀ ਸੀ ਅਤੇ ਇੱਥੋਂ ਮੈਂ ਖਰੀਦਿਆ ਸੀ ਇਹ ਅਤੇ ਉਹ ਜੋ ਕਿ ਮੇਰੀ ਇੱਛਾ ਦੇ ਮੁਤਾਬਿਕ ਉਹ ਨਹੀਂ ਚੀਜ਼ ਜਿਹੜੀ ਵਿਖਾਈ ਗਈ ਸੀ ਉਹ ਨਹੀਂ ਤੁਹਾਡੇ ਦੁਆਰਾ ਮੈਨੂੰ ਭੇਜੀ ਗਈ ਸੋ ਕਿਰਪਾ ਕਰਕੇ ਮੈਨੂੰ ਵ ਇਵੇਂ ਦੀ ਮਤਲਬ ਚੀਜ਼ਾਂ ਤੁਸੀਂ ਐ ਧਿਆਨ ਰੱਖਿਆ ਕਰੋ ਕਿ ਜਿਹੜੀ ਚੀਜ਼ ਗਾਹਕ ਨੂੰ ਜਾ ਰਹੀ ਹੈ ਜਿਹੜੀ ਚੀਜ਼ ਅਸੀਂ ਵਿਖਾ ਰਹੇ ਹਾਂ ਕਿ ਉਹੀ ਜਾ ਰਹੀ ਹੈ ਸੋ ਮਿਹਰਬਾਨੀ ਕਰਕੇ ਤੁਸੀਂ ਸਹੀ ਤਰੀਕੇ ਨਾਲ ਸਾਨੂੰ ਇਹ ਬਦਲ ਕੇ ਦਿਓ ਤੁਹਾਡੀ ਮਿਹਰਬਾਨੀ ਹੋਏਗੀ ਜੀ